ਹੈਲੋ ਹਾਂਜੀ ਸਰ

ਸਰ ਸਾਡੇ ਕੋਲ ਕਾਫ਼ੀ ਕੰਪਨੀ ਦੇ ਬੂਟ ਹੈ ਬ੍ਰੈਂਡਿਡ ਸ਼ੂਜ ਵੀ ਹੈਗੇ ਹੈ ਸਾਡੇ ਕੋਲ ਜਿੱਦਾਂ ਐਡੀਡਾਸ ਹੋ ਗਏ ਰੀਬੋਕ ਹੋ ਗਏ ਅਤੇ ਹੋਰ ਵੀ ਸਾਡੇ ਕੋਲ ਕਾਫ਼ੀ ਹੈਗੇ ਹੈ ਜੀ ਸਰ ਸਾਡੇ ਕੋਲ ਜਿੱਦਾਂ ਐਡੀਡਾਸ ਹੋ ਗਿਆ ਰੀਬੋਕ ਹੋ ਗਿਆ ਨਾਈਕ ਹੋ ਗਿਆ ਇਹ ਤੋਂ ਬਾਅਦ ਏਅਰ ਦੇ ਸ਼ੂਜ ਹੋ ਗਏ ਹੈ ਇਹ ਜਿੱਦਾਂ ਜਿੱਦਾਂ ਹੁਣ ਤੁਹਾਡੀ ਤੁਹਾਡੀ ਜਿਹੜੀ ਤੁਸੀਂ ਤੁਹਾਡੀ ਪਰਚੇਜਿੰਗ ਕਪੈਸਟੀ ਪਰ ਹੈ ਸਰ ਤੁਸੀਂ ਤਾਂ ਮਤਲਬ ਕਿੰਨੇ ਕੁ ਪੈਸੇ ਖਰਚਣਾ ਚਾਹੁੰਦੇ ਹੈਗੇ ਹੈ ਅੱਠ ਨੰਬਰ ਸਰ ਸਰ ਉਹ ਤਾਂ ਜਿੱਦਾਂ ਹੁਣ ਤੁਹਾਨੂੰ ਐਡੀਡਾਸ ਦੇ ਮਿਲ ਜੂਗੇ ਉਹਦੇ ਵਿੱਚ ਏਅਰ ਦੇ ਵੀ ਹੈਗੇ ਹੈ ਅੱਛੀ ਕੋਆਲਟੀ ਦੇ ਮਿਲ ਜੂਗੇ ਤੁਹਾਨੂੰ ਇੰਨੇ ਕੁ ਇੰਨੇ ਕੁ ਪੈੇਸਿਆਂ 'ਚ ਤੁਹਾਡੇ ਕੋਲੋਂ ਹਾਂਜੀ ਸਰ ਇੱਕ ਇਹਦੇ ਇਲਾਵਾ ਹੁਣ ਸਰ ਇਹਦੇ ਇਲਾਵਾ ਇੱਕ ਨਾ ਸਾਡੇ ਨਾ ਡਿੰਸਕਾਊਂਟ ਵੀ ਚੱਲਿਆ ਕਰਦਾ ਹੁਣ ਜਿੱਦਾਂ ਹੁਣ ਦੀਵਾਲੀ ਔਫ਼ਰ ਨਹੀਂ ਹੈਗਾ ਹੈ ਜੀ ਹਾਂਜੀ ਹਾਂਜੀ ਉਹ ਸਾਡੇ ਕੋਲ ਇੱਦਾਂ ਹੈ ਨਾ ਜਿੱਦਾਂ ਹੁਣ ਕਈ ਸ਼ੂਜ 'ਤੇ ਹੈਗਾ ਫੀਫਟੀ ਪ੍ਰਸੈਂਟ ਡਿੰਸਕਾਊਂਟ ਚੱਲਿਆ ਕਰਦਾ ਹੈਗਾ ਹੈ ਉਹ ਸ਼ੂਜ ਦੇਖ ਕੇ ਹੈ ਜਿੱਦਾਂ ਹੁਣ ਇੱਕ ਵੀ ਸ਼ੂਜ 'ਤੇ ਕੰਪਨੀ ਦੇਖ ਕੇ ਹੈ ਤੁਹਾਡੇ ਕੋਲ ਜਿੱਦਾਂ ਅਲੱਗ ਅਲੱਗ ਦੇ ਅਲੱਗ ਅਲੱਗ ਹਿਸਾਬ ਨਾਲ਼ ਡਿੰਸਕਾਊਂਟ ਚੱਲਿਆ ਕਰਦਾ ਹੈਗਾ ਜੀ

ਸਰ ਅਸੀਂ ਔਲਮੌਸਟ ਸਾਰੇ ਸਾਰੇ ਬ੍ਰੈਂਡ ਦੇ ਆਪਾਂ ਡੀਲ ਕਰਦੇ ਹੈਗੇ ਹੈ ਤੁਸੀਂ ਦੱਸੋ ਜਿਹੜੇ ਵੀ ਜਿਹੜੇ ਵੀ ਤੋਂ ਇੰਨਟ੍ਰਸਟ ਐਡੀਡਾਸ ਦਾ ਸਰ ਹੈਗਾ ਉਹਦਾ ਫੀਫਟੀ ਪ੍ਰਸੈਂਟ ਡਿੰਸਕਾਊਂਟ ਚੱਲਿਆ ਕਰਦਾ ਜੀ ਉਹ ਸਰ ਜਿਹੜਾ ਰੀਬੁੱਕ ਹੈਗਾ ਹੈ ਰੀਬੁੱਕ 'ਤੇ ਫੌਰਟੀ ਪ੍ਰਸੈਂਟ ਡਿੰਸਕਾਊਂਟ 'ਤੇ ਚੱਲਿਆ ਕਰਦਾ ਹੈ ਅਤੇ ਜਿਹੜੇ ਏਅਰ ਦਾ ਤੁਸੀਂ ਇੱਕ ਗੱਲ ਕੀਤੀ ਸੀਗੀ ਜਿਹੜੇ ਦੋ ਹਜ਼ਾਰ ਦੇ ਸ਼ੂਜ ਅਤੇ ਬ ਸ਼ੂਜ ਬਾਰੇ ਦੱਸਿਆ ਸੀ ਤੁਹਾਨੂੰ ਮੈਂ ਜੀ ਉਹ ਸਰ ਉਹ ਸੀਕਸਟੀ ਪ੍ਰਸੈਂਟ ਡਿੰਸਕਾਊਂਟ 'ਤੇ ਚੱਲਿਆ ਕਰਦਾ ਹੈ ਉਹ ਦੀਵਾਲੀ ਕਰਕੇ ਸਿਰਫ ਲਿਮਟਿਡ ਟਾਈਮ ਵਾਸਤੇ ਹੀ ਹੈ ਉਹ ਹਾਂਜੀ ਇੱਕ ਦੋ ਦਿਨ ਬ ਇੱਕ ਦੋ ਦਿਨ ਤੱਕ ਹੀ ਹੈ ਡਿਸਕਾਊਂਟ ਚੱਲਿਆ ਕਰਦਾ ਹੈ ਉਹ ਤੋਂ ਬਾਅਦ ਉਹ ਤੋਂ ਬਾਅਦ ਉਹ ਖ਼ਤਮ ਹੋ ਜਾਣਾ ਹੈਗਾ ਜੀ ਉਹ

ਹਾਂਜੀ ਕੋਈ ਨਾ ਸਰ ਤੁਸੀਂ ਇੱਕ ਅੇਨੀ ਟਾਈਮ ਸਾਡੀ ਦੁਕਾ ਸ਼ਾਪ 'ਤੇ ਆ ਸਕਦੇ ਹੋ ਸਰ ਸਾਡੇ ਸਰ ਜੀ ਸ਼ੋਪ ਦਾ ਨਾਮ ਹੈਗਾ ਸਿਮਰਨ ਬੂਟ ਹਾਊਸ ਹਾਂਜੀ ਹਾਂਜੀ ਸਰ ਕਰ ਲੈਂਦੇ ਹੈ ਜੀ ਓਕੇ ਸਰ ਥੈਂਕ ਯੂ ਜੀ ਥੈਂਕ ਯੂ ਫੌਰ ਕੋਲਿੰਗ ਸਰ